ਪੰਜਾਬੀ ਭਾਸ਼ਾ ਬਹੁਤ ਹੀ ਵਿਲੱਖਣ ਭਾਸ਼ਾ ਹੈ ਇਹ ਸਾਡੀ ਮਾਤ ਭਾਸ਼ਾ ਏ ਅਸੀਂ ਛੋਟੇ ਹੁੰਦੇ ਤੋਂ ਆਪਣੇ ਘਰ ਵਿੱਚ ਪੰਜਾਬੀ ਬੋਲਦੇ ਹਾਂ ਪੰਜਾਬੀ ਸਿੱਖਦੇ ਹਾਂ ਪੰਜਾਬੀ ਸਿਖਾਉਂਦੇ ਹੈ ਅਤੇ ਪੰਜਾਬੀ 'ਚ ਹੀ ਸਾਨੂੰ ਗੱਲਾਂ ਕਰਨੀਆਂ ਬਹੁਤ ਮ ਬਹੁਤ ਵਧੀਆ ਲੱਗਦੀਆਂ ਏ ਅਤੇ ਪੰਜਾਬੀ 'ਚ ਸਾਡੇ ਲਿਟਰੇਚਰ ਵਿੱਚ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਹੈ ਪੰਜਾਬੀ ਭਾਸ਼ਾ ਵਿੱਚ ਗੱਲ ਕਰਨੀ ਮਿਠਾਸ ਆਉਂਦੀ ਹੈ ਉਹਦੇ 'ਚ ਬਹੁਤ ਜ਼ਿਆਦਾ ਅਤੇ ਪੰਜਾਬੀ ਇੱਕ ਇਹੋ ਜਿਹੀ ਭਾਸ਼ਾ ਏ ਜਿ ਜਿਹਦੇ ਨਾਲ ਆਪਾਂ ਆਪਣੇ ਨਾਲ਼ਦਿਆਂ ਨਾਲ ਬਹੁਤ ਹੀ ਖੁੱਲ ਕੇ ਗੱਲ ਕਰ ਸਕਦੇ ਐਂ ਅਤੇ ਸਾਨੂੰ ਚਾਹੀਦਾ ਹੈ ਵੀ ਪੰਜਾਬੀ ਭਾਸ਼ਾ ਨੂੰ ਹੋਰ ਜ਼ਿਆਦਾ ਫੈਲਾਇਆ ਜਾਵੇ ਵੱਖ ਵੱਖ ਸ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਇੰਡੀਆ ਦੀਆਂ ਸਟੇਟਾਂ ਵਿੱਚ ਇਹਨੂੰ ਲੈਕੇ ਜਾਇਆ ਜਾਵੇ ਤਾਂ ਜੋ ਪੰਜਾਬੀ ਪ੍ਰਫੁੱਲਿਤ ਹੋ ਸਕੇ ਧੰਨਵਾਦ